ਦੇਖੋ ਜਲੰਧਰ ਸ਼ਹਿਰ ਦਾ ਜਿਹੜਾ ਜੋਗਰਾਫੀਕਲ ਏਰੀਆ ਹੈ ਉਹ ਉਹ ਕੋਈ ਬਹੁਤ ਪਾਣੀ ਦੇ ਸਰੋਤ ਨਹੀਂ ਹਨ ਇੱਥੇ ਲੇਕਿਨ ਫਿਰ ਵੀ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਪਾਰਕ ਨੇ ਚਾਹੇ ਉਹ ਮਿਊੰਸਪੈਲਟੀ ਦੇ ਪਾਰਕ ਹੋਣ ਚਾਹੇ ਕੈਂਟੋਨਮੈਂਟ ਏਰੀਆ ਦੇ ਪਾਰਕ ਹੋਣ ਚਾਹੇ ਕਿਸੇ ਸਕੂਲਾਂ ਦੇ ਪਾਰਕ ਹੋਣ ਇਹਨਾਂ ਸਾਰੀਆਂ ਥਾਵਾਂ 'ਤੇ ਅਕਸਰ ਤੁਸੀਂ ਪਕਸ਼ੀ ਜਿਹੜੇ ਨੇ ਜਾਂ ਪੰਛੀ ਜਿਹੜੇ ਨੇ ਉਹ ਦੇਖ ਸਕਦੇ ਹੋ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦਾ ਇੱਥੇ ਵਾਤਾਵਰਨ ਹੋ ਗਿਆ ਹੈ ਕਿ ਬਹੁਤ ਜ਼ਿਆਦਾ ਵਰਾਇਟੀ ਜਾਂ ਬਹੁਤ ਭਿੰਨ ਭਿੰਨ ਤਰ੍ਹਾਂ ਦੇ ਪਕਸ਼ੀ ਜਿਹੜੇ ਨੇ ਇੱਥੇ ਨਹੀਂ ਪਾਏ ਜਾਂਦੇ ਹਾਂ ਲੇਕਿਨ ਜਿਹੜੇ ਆਮ ਘਰਾਂ ਦੇ ਵਿੱਚ ਪੰਛੀ ਪਾਏ ਜਾਂਦੇ ਨੇ ਉਹਨਾਂ ਵਿੱਚ ਚਿੜੀਆਂ ਛੋਟੀਆਂ ਚਿੜੀਆਂ ਵੱਡੀਆਂ ਚਿੜੀਆਂ ਇੱਥੇ ਬੁਲਬੁਲ ਤੋਤੇ ਕਬੂਤਰ ਤਾਂ ਬਹੁਤ ਤਰ੍ਹਾਂ ਦੇ ਆਮ ਹੋ ਗਏ ਨੇ ਕਬੂਤਰ ਜਿਹੜੇ ਨੇ ਇੱਕ ਦੇਸੀ ਬਰਾਂਡ ਬਰੀਡ ਵਾਲੇ ਕਬੂਤਰ ਵੀ ਇੱਥੇ ਬਹੁਤ ਪਾਏ ਜਾਂਦੇ ਨੇ ਔਰ ਇਮਪੋਰਟਡ ਬਰੀਡ ਵਾਲੇ ਕਬੂਤਰ ਵੀ ਬਹੁਤ ਪਾਏ ਜਾਂਦੇ ਨੇ ਇਸ ਤੋਂ ਇਲਾਵਾ ਜਿਹੜੀ ਚੀਲ ਹੈ ਇੱਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਇੱਲਾਂ ਵੀ ਇੱਥੇ ਬਹੁਤ ਜ਼ਿਆਦਾ ਦੇਖੀਆਂ ਜਾਂਦੀਆਂ ਨੇ ਜਿਹੜੀ ਜਗ੍ਹਾ ਦੇ ਉੱਪਰ ਜ਼ਿਆਦਾ ਛਾਂ ਵਾਲਾ ਮਾਹੌਲ ਹੋਵੇਗਾ ਔਰ ਲੋਕਾਂ ਦੀ ਆਵਾਜਾਈ ਘੱਟ ਹੈ ਜਿਵੇਂ ਕਿ ਪਾਰਕਾਂ ਦੇ ਕੁਝ ਏਰੀਆ ਦੇ ਵਿੱਚ ਹੈਗਾ ਉੱਥੇ ਤੁਸੀਂ ਕਾਲੇ ਰੰਗ ਦੀ ਛੋਟੀ ਛੋਟੀ ਚਿੜੀਆਂ ਵੀ ਦੇਖ ਸਕਦੇ ਹੋ ਜਿਹੜੀਆਂ ਨੋਰਮਲੀ ਘਰਾਂ ਦੇ ਵਿੱਚ ਜਾਂ ਮੁਹੱਲਿਆਂ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦੀਆਂ ਪਲਸ ਇਸ ਤੋਂ ਇ ਇਲਾਵਾ ਜਿਹੜੇ ਲੋਕਾਂ ਨੂੰ ਦਾਣਾ ਪਾਣ ਦਾ ਅੱਜ ਕੱਲ੍ਹ ਕਾਫ਼ੀ ਪੰਡਿਤ ਲੋਕ ਵੀ ਜਿਹੜੇ ਨੇ ਉਹ ਐਡਵਾਈਜ ਕਰਦੇ ਨੇ ਉਸ ਕਰਕੇ ਕਬੂਤਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਧੰਨਵਾਦ